ਮੈਂ ਮੁਸਲਿਮ ਫੈਮਿਲੀ ਤੋਂ ਬਿਲੌਂਗ ਕਰਦੀ ਹਾਂ ਜਿਸ ਵਿੱਚ ਪੰਜ ਟਾਈਮ ਨਮਾਜ਼ ਪੜ੍ਹਨਾ ਹੁੰਦਾ ਹੈ ਪੰਜ ਟਾਈਮ ਨਮਾਜ਼ ਮੈਂ ਪੂਰੇ ਪੰਜ ਟਾਈਮ ਦਾ ਨਮਾਜ਼ ਪੜ੍ਹਦੀ ਹਾਂ ਪਹਿਲਾ ਨਮਾਜ਼ ਸੁਬਾਹ ਦਾ ਪੰਜ ਵਜੇ ਹੁੰਦਾ ਹੈ ਅਤੇ ਦੂਜਾ ਨਮਾਜ਼ ਦੁਪਹਿਰ ਦੇ ਇੱਕ ਵਜੇ ਅਤੇ ਤੀਜਾ ਨਮਾਜ਼ ਸ਼ਾਮ ਦੇ ਚਾਰ ਵਜੇ ਅਤੇ ਫਿਰ ਉਸ ਅਤੇ ਬਾਅਦ ਸਾਢੇ ਛੇ ਵਜੇ ਹੁੰਦਾ ਹੈ ਅਤੇ ਉਸ ਤੇ ਬਾਅਦ ਸਾਢੇ ਨੌ ਵਜੇ ਅਜ਼ਾਨ ਹੁੰਦਾ ਹੈ ਇਹ ਅਜ਼ਾਨ ਇਹਨਾਂ ਇੰਨੇ ਟਾਈਮ ਵਿੱਚ ਅਸੀਂ ਨਮਾਜ਼ ਪੜ੍ਹਦੇ ਹਾਂ ਇਸ ਨੂੰ ਪੜ੍ਹਕੇ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਇਹ ਪੜ੍ਹਨ ਲਈ ਅਸੀਂ ਕਿਸੀ ਮਸਜਿਦ 'ਤੇ ਨਹੀਂ ਜਾਂਦੇ ਆ ਅਸੀਂ ਆਪਣੇ ਘਰ ਵਿੱਚ ਵੀ ਪੜ੍ਹ ਸਕਦੇ ਹੈਂ